ਬਚਪਨ ਵਿੱਚ ਮੈਂ ਇਤਿਹਾਸ ਬਾਰੇ ਬਹੁਤ ਕੁਝ ਸਿੱਖਿਆ ਹੈ ਜੀ ਵੀ ਸਕੂਲ ਵਿੱਚ ਟੀਚਰ ਵੀ ਬਹੁਤ ਵਧੀਆਂ ਹਨ ਅਤੇ ਉਹਨਾਂ ਨੇ ਵੀ ਸਾਨੂੰ ਹਿਮਾ ਇਤਿਹਾਸ ਬਾਰੇ ਬਹੁਤ ਵਧੀਆ ਦੱਸਿਆ ਹੈ ਜਿੱਦਾਂ ਕਿ ਨੈਣਾਂ ਦੇਵੀ ਵੈਸ਼ਨੋ ਮਾਤਾ ਜਵਾਲਾਜੀ ਆਦਿ ਅਤੇ ਚਿੰਤਪੁਰਨੀ ਔਰ ਅਨੰਦਪੁਰ ਸਾਹਿਬ ਵਿੱਚ ਇਤਿਹਾਸ ਬਹੁਤ ਹੀ ਬ ਬਾਬਾ ਜੀ ਨੇ ਰਚਾਇਆ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਸਾਡੇ ਲਈ ਕੁਰਬਾਨੀਆਂ ਕੀਤੀਆਂ ਹਨ ਅਤੇ ਜਿੱਦਾਂ ਛੋ ਭੱਠਾ ਸਾਹਿਬ ਅਤੇ ਚਮਕੌਰ ਸਾਹਿਬ ਫਤਹਿਗੜ ਸਾਹਿਬ ਆਦਿ ਬਹੁਤ ਹਨ